ਦਸਤ ਦਾ ਇਲਾਜ ਸਾਡੇ ਪੁਰਖਿਆਂ ਦੁਆਰਾ ਕੁਝ ਇਸ ਤਰ੍ਹਾਂ ਦੱਸਿਆ ਗਿਆ ਹੈ ਕਿ ਜੇਕਰ ਦਸਤ ਦਾ ਕੋਈ ਤੋੜ ਨਾ ਮਿਲੇ ਤਾਂ ਉਹ ਸਾਨੂੰ ਅਜਵੈਣ ਦੀ ਫੱਕੀ ਮਾਰਨ ਦੀ ਸਲਾਹ ਦਿੰਦੇ ਨੇ ਜੋ ਕਿ ਪਾਣੀ ਦੇ ਨਾਲ ਕੀਤੀ ਜਾਂਦੀ ਹੈ ਅਤੇ ਜੇਕਰ ਇਸ ਦਾ ਵੀ ਫਰਕ ਨਾ ਪਵੇ ਤਾਂ ਉਹ ਸਾਨੂੰ ਚੂਰਨ ਨੂੰ ਖਾਣ ਲਈ ਕਹਿੰਦੇ ਹਨ ਅਤੇ ਜੇਕਰ ਇਸ ਤੋਂ ਵੀ ਕੋਈ ਫਰਕ ਨਾ ਪਵੇ ਤਾਂ ਸਾਨੂੰ ਨਿੱਜੀ ਡਾਕਟਰ ਕੋਲ਼ ਜਾ ਕੇ ਆਪਣੀ ਦਵਾਈ ਲੈਣੀ ਚਾਹੀਦੀ ਹੈ ਅਤੇ ਜਿਸ ਨਾਲ ਸਾਡਾ ਇਲਾਜ ਹੋ ਸਕੇ